ਹਾਂਜੀ ਗਰਮੀਆਂ ਵਿੱਚ ਅਸੀਂ ਪੰਛੀਆਂ ਲਈ ਕਾਫੀ ਤਰ੍ਹਾਂ ਦੀਆਂ ਸਹੂਲਤਾਂ ਜੋ ਉਹਨਾਂ ਨੂੰ ਦੇ ਸਕਦੇ ਹਾਂ ਜਿਵੇਂ ਕਿ ਪਾਣੀ ਛੱਤ 'ਤੇ ਰੱਖ ਸਕਦੇ ਹਾਂ ਕਿਉਂਕਿ ਗਰਮੀਆਂ ਵਿੱਚ ਜ਼ਿਆਦਾ ਲੂਹ ਪੈਣ ਕਰਕੇ ਪੰਛੀਆਂਂ ਲਈ ਵੀ ਔਖਾ ਹੁੰਦਾ ਹੈ ਜਿਹਦੇ ਕਰਕੇ ਸਾਨੂੰ ਛੱਤ 'ਤੇ ਪਾਣੀ ਰੱਖਣਾ ਚਾਹੀਦਾ ਏ ਅਤੇ ਪੰਛੀਆਂ ਦੇ ਖਾਣ ਲਈ ਦਾਣੇ ਜਿਵੇਂ ਕਿ ਕਣਕ ਦੇ ਦਾਣੇ ਪੀਸ ਕੇ ਦਲੀਆ ਅਤੇ ਮੱਕੀ ਦੇ ਦਾਣੇ ਬਾਜਰਾ ਅਤੇ ਆਪਣੀਆਂ ਜੋ ਚੂਰੀ ਵਗੈਰਾ ਹੋਰ ਆਪਾਂ ਰੱਖ ਸਕਦੇ ਉਹਨਾਂ ਲਈ ਤਾਂ ਜੋ ਪੰਛੀਆਂ ਨੂੰ ਗਰਮੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਅਤੇ ਆਪਾਂ ਹੋਰ ਵੀ ਕਈ ਤਰ੍ਹਾਂ ਦੇ ਯਤਨ ਕਰ ਸਕਦੇ ਹਾਂ ਜਿਵੇਂ ਕਿ ਪਾਣੀ ਜੋ ਹੈ ਛੱਤਾਂ 'ਤੇ ਰੱਖ ਸਕਦੇ ਹਾਂ ਮਟਕਿਆਂ ਵਿੱਚ ਭਰ ਭਰ ਕੇ ਅਤੇ ਰੋਟੀਆਂ ਵੀ ਉਹਨਾਂ ਨੂੰ ਪਾ ਸਕਦੇ ਹਾਂ